ਹਾਂਜੀ ਵੈਸੇ ਤਾਂ ਮੈਨੂੰ ਇਹਦੇ ਬਾਰੇ ਜ ਇਹਦੇ ਬਾਰੇ ਜ਼ਿਆਦਾ ਨੋਲੇਜ ਤਾਂ ਮੈਨੂੰ ਜਾਣਕਾਰੀ ਤਾਂ ਹੈ ਨਹੀਂ ਤੁਸੀਂ ਜੋ ਵੀ ਪੁੱਛ ਰਹੇ ਹੋ ਕਿ ਕੀ ਤੁਸੀਂ ਸਾਨੂੰ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਬਾਰੇ ਦੱਸ ਸਕਦੇ ਹੋ ਜ਼ਿਆਦਾ ਤਾਂ ਮੈਨੇ ਇਹਦੇ ਬਾਰੇ ਨਹੀਂ ਪੜ੍ਹਿਆ ਬਟ ਪਰੰਤੂ ਕਹਿ ਪਰ ਕਹਿ ਸਕਦਾਂ ਕਿ ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਕਿ ਪ੍ਰਧਾਨ ਮੰਤਰੀ ਦੁਆਰਾ ਕੋਈ ਐਸੀ ਜੀ ਪਾਲਣ ਪਾਲਣ ਪੋਸ਼ਣ ਨੂੰ ਲੈ ਕੇ ਕੋਈ ਪੋਸ਼ਣ ਕਿਸੇ ਦਾ ਵੀ ਬੱਚਿਆਂ ਦਾ ਹੋ ਸਕਦਾ ਛੋਟੇ ਬੱਚਿਆਂ ਦਾ ਜਿਵੇਂ ਕਿ ਜਾਂ ਜਿਵੇਂ ਆਪਾਂ ਆਂਗਣਵਾੜੀ ਦੀ ਗੱਲ ਕਰ ਲਈਏ ਕਿ ਹੁਣ ਸਰਕਾਰ ਕੁਛ ਇਹੋ ਜਿਹੀ ਸਕੀਮਾਂ ਲੈ ਕੇ ਆਉਂਦੀ ਹੈ ਕਿ ਛੋਟੀ ਜਿਹੜੇ ਬੱਚੇ ਨੇ ਦੁ ਜੀਰੋ ਤੋਂ ਲੈ ਕੇ ਸਿਕਸ ਯੀਅਰ ਤੱਕ ਜੀਰੋ ਤੋਂ ਲੈ ਕੇ ਛੇ ਸਾਲਾਂ ਤੱਕ ਦੇ ਜਿਹੜੇ ਬੱਚੇ ਆਉਂਦੇ ਨੇ ਜਿਹਦੇ ਕੈਟ ਇਸ ਕੈਟਾਗਰੀ ਦੇ ਵਿੱਚ ਉਹਨਾਂ ਦਾ ਪੋਸ਼ਣ ਅੱਛੇ ਤਰੀਕੇ ਨਾਲ ਹੋ ਸਕੇ ਤਾਂ ਆਂਗਣਵਾੜੀ ਦੇ ਵਿੱਚ ਗਵਰਮੈਂਟ ਸਰਕਾਰ ਆ ਜਿਹੜੀ ਆਪਣੀ ਬਹੁਤ ਸਕੀਮਾਂ ਚਲਾਉਂਦੀ ਹੈ ਕਿ ਉਹਨਾਂ ਨੂੰ ਜਿਵੇਂ ਸੁੱਕਾ ਦੁੱਧ ਪ੍ਰੋਵਾਈਡ ਕਰਨਾ ਜਾਂ ਦਲੀਆ ਪ੍ਰੋਵਾਈਡ ਕਰਨਾ ਜਾਂ ਹੋਰ ਕੁਛ ਜਿਹੜੀ ਕਿ ਪ੍ਰੋਟੀਨ ਜਿਹਨਾਂ ਵਿੱਚ ਪ੍ਰੋਟੀਨ ਹੋਵੇ ਦਾਲਾਂ ਸਬਜ਼ੀਆਂ ਜਿਹਨਾਂ 'ਚ ਪ੍ਰੋਟੀਨ ਹੋਵੇ ਜਾਂ ਫਿਰ ਕੇਲਾ ਜਿਹੜਾ ਫਲਾਂ ਦੇ ਵਿੱਚ ਜਾਂ ਸੇਬ ਇਹੋ ਜਿਹਾ ਕੁਛ ਦੇਣਾ ਕਿ ਤਾਂ ਕਿ ਬੱਚਿਆਂ ਦੇ ਵਿੱਚ ਜਿਹੜਾ ਪੋਸ਼ਣ ਹੈ ਉਹ ਠੀਕ ਹੋ ਸਕੇ ਠੀਕ ਆ ਤਾਂ ਇਹ ਚੀਜ਼ਾਂ ਆਉਂਦੀਆਂ ਨੇ ਸਰਕਾਰ ਦੁਆਰਾ ਕੱਢੀਆਂ ਜਾਂਦੀਆਂ ਨੇ ਅਤੇ ਬਾਕੀ ਇੰਨੀ ਜ਼ਿਆਦਾ ਜਾਣਕਾਰੀ ਮੈਨੂੰ ਇਸ ਤੋਂ ਇਲਾਵਾ ਨਹੀਂ ਹੈ